ਮੇਰੇ ਕੋਲ ਪਹਿਲਾਂ ਮੋਬਾਈਲ ਫੋਨ ਸੀ ਜਿਹਨੂੰ ਬਟਨਾ ਵਾਲਾ ਫੋਨ ਵੀ ਕਹਿੰਦੇ ਹਨ ਅਤੇ ਉਸ ਦਾ ਪ੍ਰਯੋਗ ਬਹੁਤ ਔਖਾ ਹੁੰਦਾ ਸੀ ਜੇ ਕੋਈ ਮੈਸੇਜ ਟਾਈਪ ਕਰਨਾ ਹੈ ਤਾਂ ਇੱਕ ਹੀ ਬਟਨ ਨੂੰ ਕਿੰਨੀ ਵਾਰ ਟਾਈਪ ਕਰਨਾ ਪੈਂਦਾ ਸੀ ਅਤੇ ਬੜਾ ਹੀ ਲਿਖਣਾ ਉਹਦੇ 'ਤੇ ਲਿਖਣਾ ਬੜਾ ਹੀ ਮੁਸ਼ਕਿਲ ਹੁੰਦਾ ਸੀ ਅਤੇ ਜਿਵੇਂ ਜਿਵੇਂ ਟੈਕਨੋਲੋਜੀ ਡਿਵੈਲਪ ਹੁੰਦੀ ਗਈ ਉੱਨਤੀ ਹੁੰਦੀ ਗਈ ਅਤੇ ਉਵੇਂ ਉਵੇਂ ਫੋਨ ਦੇ ਵਿੱਚ ਵੀ ਬਦਲਾਅ ਆ ਗਿਆ ਅਤੇ ਹੁਣ ਜਿਹੜੀ ਹੈ ਸਮਾਰਟ ਫੋਨ ਆ ਗਏ ਹਨ ਜਿਸ ਦੇ ਨਾਲ ਕਿ ਲਿਖਣ ਵਿੱਚ ਜੋ ਕਿ ਬਹੁਤ ਫਾਸਟ ਹਨ ਅਤੇ ਉਸ ਫੋਨ ਨਾਲੋਂ ਕਈ ਹਜ਼ਾਰ ਗੁਣਾ ਵਧੀਆ ਹਨ